ਜਦੋਂ ਮੈਂ ਹੇਮਕੁੰਟ ਸਾਹਿਬ ਦੀ ਯਾਤਰਾ ਵਾਸਤੇ ਉਤਰਾਖੰਡ ਮੋਟਰਸਾਇਕਲ ਦੇ ਉੱਤੇ ਗਿਆ ਉਹ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਉਣ ਸਮੇਂ ਸ੍ਰੀ ਨਗਰ ਵਾਲੇ ਰਾਹ ਵਿੱਚ ਬਹੁਤ ਵੱਡਾ ਜਾਮ ਮਿਲਿਆ ਜਿਹੜੀ ਕਿ ਲਗਭਗ ਦੋ ਤਿੰਨ ਕਿਲੋਮੀਟਰ ਦਾ ਸੀ ਉਸ ਟਾਇਮ ਬੜਾ ਹੀ ਔਖਾ ਮੋਟਰਸਾਇਕਲ ਨਿਕਾਲਣਾ ਵੀ ਬਹੁਤ ਔਖਾ ਹੋਇਆ ਅਤੇ ਗੱਡੀਆਂ ਵਾਲਿਆਂ ਦਾ ਤਾਂ ਬਹੁਤ ਔਖਾ ਹੀ ਹੋਇਆ ਉਹਨਾਂ ਨੂੰ ਘੰਟਾ ਘੰਟਾ ਦੋ ਦੋ ਤਿੰਨ ਘੰਟੇ ਜਾਮ ਦੇ ਵਿੱਚ ਹੀ ਖੜ੍ਹਨਾ ਖੜ੍ਹਨਾ ਰ ਪਿਆ ਰਿਹਾ ਅਤੇ ਉਸ ਸਮੇਂ ਦੌਰਾਨ ਇੱਕ ਲੰਬਾ ਬਹੁਤ ਜ਼ਿਆਦਾ ਲੰਬਾ ਸਫ਼ਰ ਹੋਣ ਕਰਕੇ ਇੱਕ ਸਰੀਰਕ ਥਕਾਵਟ ਵੀ ਬਹੁਤ ਜ਼ਿਆਦਾ ਹੋਈ ਅਤੇ ਚਲੋ ਵਧੀਆ ਤਾਂ ਲੱਗਿਆ ਪਰ ਸਰੀਰਕ ਥਕਾਵਟ ਬਹੁਤ ਹੋਈ ਅਤੇ ਜਾਮ ਨੇ ਬੜਾ ਹੀ ਸਾਨੂੰ ਪਰੇਸ਼ਾਨ ਕੀਤਾ